ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਅੱਜ ਕੱਲ੍ਹ ਦੇ ਸਕੂਲਾਂ ਵਿੱਚ ਬਹੁਤ ਇਸ ਟਾਈਮ 'ਤੇ ਪੜ੍ਹਾਈ ਤੋਂ ਇਲਾਵਾ ਗਤੀਵਿਧੀਆਂ ਹੁੰਦੀਆਂ ਹਨ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹਨ ਹੁਣ ਤਾਂ ਬਹੁਤ ਜ਼ਿਆਦਾ ਖੇਡਾਂ ਆ ਗਈਆਂ ਹਨ ਜਿੱਦਾਂ ਕਿ ਅਕਿਊਪਮੈਂਟਾਂ ਵੀ ਆ ਗਏ ਅਕਿਉਪਮੈਂਟ ਵੀ ਆ ਗਏ ਹਨ ਕਈਆਂ ਖੇਡਾਂ ਦੇ ਜਿੱਦਾਂ ਕਿ ਕ੍ਰਿਕਟ ਵਗੈਰਾ ਦੇ ਲਈ ਸਕੂਲਾਂ ਵਿੱਚ ਹੀ ਗਰਾਉਂਡ ਬਣਾਏ ਜਾਂਦੇ ਹਨ ਦੌੜ ਦੇ ਲਈ ਵੀ ਸਕੂਲਾਂ ਵਿੱਚ ਹੀ ਗਰਾਉਂਡ ਬਣਾਈ ਜਾਂਦੀ ਹੈ ਤਾਂ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਸਭ ਕੁਛ ਸਹੀ ਤੌਰ 'ਤੇ ਸਿਖਾਇਆ ਜਾਵੇ ਲੇਕਿਨ ਜਦੋਂ ਮੈਂ ਆਪਣੇ ਟਾਈਮ 'ਤੇ ਹੁੰਦਾ ਸੀ ਛੋਟੇ ਹੁੰਦੇ ਹੋਏ ਸਾਡੇ ਟੀਚਰ ਬਸ ਛੋਟੀਆਂ ਜਿਹੀਆਂ ਕੁਰਸੀਆਂ ਲਾ ਕੇ ਸਾਨੂੰ ਕਹਿੰਦੇ ਸੀ ਕਿ ਆਲੇ ਦੁਆਲੇ ਮਿਊਜ਼ਿਕ ਚੇਅਰ ਖੇਡ ਲਉ ਇਹਦੇ ਜਾਂ ਫਿਰ ਹੋਰ ਵੀ ਕਈ ਤਰੀਕੇ ਦੇ ਰੇਸਾਂ ਹੁੰਦੀਆਂ ਸੀ ਲੇਕਿਨ ਅੱਜ ਕੱਲ੍ਹ ਦੇ ਲਈ ਤਾਂ ਸਕੂਲ ਦੇ ਵਿੱਚ ਹੀ ਸਾਰੀ ਗੇਮਾਂ ਵਾਸਤੇ ਆ ਗਈਆਂ ਹਨ ਜਿੱਦਾਂ ਕਿ ਚੈੱਸ ਕ੍ਰਿਕੇਟ ਬੈਡਮਿੰਟਨ ਵੋਲੀਬੋਲ ਅਤੇ ਹੋਰ ਵੀ ਕਈ ਖੇਡਾਂ ਜਿਨ੍ਹਾਂ ਨੂੰ ਕਿ ਸਕੂਲ ਦੇ ਵਿੱਚ ਹੀ ਸਪੈਸ਼ਲ ਟੀਚਰ ਅਲੋਟ ਹੁੰਦੇ ਹਨ ਜੋ ਕਿ ਉਨ੍ਹਾਂ ਨੂੰ ਉੱਥੇ ਹੀ ਸਿਖਾਇਆ ਜਾਂਦਾ ਹੈ ਕਿ ਇਹ ਖੇਡਾਂ ਨੂੰ ਕਿੱਦਾਂ ਵਧੀਆ ਤੋਂ ਵਧੀਆ ਤਰੀਕੇ ਨਾਲ ਖੇਡਿਆ ਜਾਵੇ ਅਤੇ ਅੱਜ ਕੱਲ੍ਹ ਦੇ ਜੋ ਬੱਚੇ ਹਨ ਉਨ੍ਹਾਂ ਨੂੰ ਵਧੀਆ ਖਿਡਵਾ ਕੇ ਨੈਸ਼ਨਲ ਅਤੇ ਉਲੰਪਿਕ ਲੈਵਲ 'ਤੇ ਵਧੀਆ ਖਿਡਾਰੀ ਬਣਾਇਆ ਜਾ ਸਕੇ ਜਿਹਦਾ ਕਿ ਨਤੀਜਾ ਅਸੀਂ ਦੇਖ ਹੀ ਰਹੇ ਹਾਂ ਕਿ ਭਾਰਤ ਉਲੰਪਿਕ ਵਿੱਚ ਬਹੁਤ ਜ਼ਿਆਦਾ ਮੈਡਲ ਜਿੱਤ ਰਿਹਾ ਹੈ ਇਸ ਕਰਕੇ ਖੇਡਾਂ ਤੋਂ ਇਲਾਵਾ ਵੀ ਅੱਜ ਕੱਲ੍ਹ ਸਕੂਲਾਂ ਵਿੱਚ ਬਹੁਤ ਸਾਰੇ ਕਰਿਕ੍ਰਮ ਹੋ ਰਹੇ